ਤਕਨਾਲੋਜੀ ਦੇ ਬੁਨਿਆਦੀ ਰੂਪ ਅੱਜ ਕੱਲ੍ਹ ਬਹੁਤ ਬਹੁਤ ਅਲੱਗ ਅਲੱਗ ਖੇਤਰ ਵਿੱਚ ਦੇਖੇ ਜਾ ਸਕਦੇ ਨੇ ਜਿਵੇਂ ਕਿ ਆਪਾਂ ਗੱਲ ਕਰੀਏ ਮੇੋਬਾਇਲ ਫ਼ੋਨ ਇੰਟਰਨੈੱਟ ਸਮਾਰਟ ਟੀ ਵੀ ਸ ਬਾਈਕਸ ਜਾਂ ਲਿਫ਼ਟ ਜਾਂ ਕਿਤੇ ਵੀ ਆਪਾਂ ਬੈਂਕਿੰਗ ਸੈਕਟਰ ਵਿੱਚ ਜਾਂ ਪੜ੍ਹਾਈ ਦੇ ਖੇਤਰ ਵਿੱਚ ਗੱਲ ਕਰੀਏ ਤਾਂ ਤਕਨਾਲੋਜੀ ਨੇ ਹਰ ਇੱਕ ਖੇਤਰ 'ਤੇ ਆਪਣਾ ਪ੍ਰਭਾਵ ਪਾਇਆ ਹੈ ਕਿਵੇਂ ਕਿ ਜੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਕੱਲ੍ਹ ਇੰਟਰਨੈੱਟ ਦੀ ਮਦਦ ਨਾਲ਼ ਆਪਾਂ ਇੱਕ ਦੂਜੇ ਨਾਲ਼ ਬਾਹਰ ਬੈਠੇ ਵੀ ਵਿਦੇਸ਼ੀ ਧਰਤੀ 'ਤੇ ਬੈਠੇ ਹਾਂ ਇੱਧਰ ਗ ਵੀ ਆਪਾਂ ਆਪਣੇ ਦੇਸ਼ ਬੈਠੇ ਹਾਂ ਤਾਂ ਉੱਥੋਂ ਵੀ ਆਪਾਂ ਅੱਗੇ ਜੁੜੇ ਰਹਿ ਸਕਦੇ ਹਾਂ ਇੱਕ ਦੂਜੇ ਦੇ ਨਾਲ਼ ਕਿ ਦੇਖਿਆ ਜਾਵੇ ਤਾਂ ਕੁਛ ਵੀ ਅੱਜ ਕੱਲ੍ਹ ਤੁਸੀਂ ਖਾਣੇ ਨੂੰ ਮੰਗਵਾਉਣਾ ਹੈ ਤਾਂ ਤੁਸੀਂ ਕੁਛ ਵੀ ਆਪਣਾ ਔਨਲਾਈਨ ਕੁਛ ਵੀ ਖਰੀਦਣਾ ਚਾਹੁੰਦੇ ਹੋ ਤਾਂ ਸਭ ਕੁਛ ਆ ਤੁਸੀਂ ਇੰਟਰਨੈੱਟ ਦੀ ਤਕਨਾਲੋਜੀ ਦੀ ਮਦਦ ਦੇ ਨਾਲ਼ ਹਰ ਇੱਕ ਚੀਜ਼ ਘਰ ਬੈਠੇ ਹਾਸਲ ਕਰ ਸਕਦੇ ਹੋ ਕਿਵੇਂ ਮੈਂ ਕਿ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਇਕੱਲੇ ਨੂੰ ਪ੍ਰਭਾਵ ਨਹੀਂ ਕੀਤਾ ਤਕਨਾਲੋਜੀ ਨੇ ਆਪਣੇ ਸਾਰੇ ਵਰਗ ਨੂੰ ਆਪਣੀ ਸਾਰੀ ਜ਼ਿੰਦਗੀ ਨੂੰ ਇਨਸਾਨ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਨਾਲ਼ ਕਿ ਜ਼ਿੰਦਗੀ ਅੱਜ ਕੱਲ੍ਹ ਬਹੁਤ ਹੀ ਅਸਾਨ ਬਣ ਗਈ ਹੈ ਜਿਹੜੇ ਕੰਮ ਅੱਗੇ ਅੱਗੇ ਬਹੁਤ ਦਿਨਾਂ 'ਚ ਹੁੰਦੇ ਸੀ ਉਹ ਅੱਜ ਕੱਲ੍ਹ ਮਿੰਟਾਂ ਸਕਿੰਟਾਂ ਵਿੱਚ ਹੋਣ ਲੱਗੇ ਨੇ ਗੱਲ਼ ਕਰ ਲਈਏ ਇੱਕ ਬੈਂਕਿੰਗ ਖੇਤਰ ਦੀ ਤਾਂ ਤੁਸੀਂ ਸਭ ਕੁਛ ਘਰ ਬੈਠੇ ਆਪਣਾ ਔਨਲਾਇਨ ਦੇਖ ਸਕਦੇ ਹੋ ਤਾਂ ਪਹਿਲਾਂ ਕੀ ਹੁੰਦਾ ਸੀ ਲੋਕਾਂ ਨੂੰ ਬਹੁਤ ਬਹੁਤ ਲੰਬੀਆਂ ਲਾਈਨਾਂ ਵਿੱਚ ਖੜ੍ਹਨਾ ਪੈਂਦਾ ਸੀ ਜਿਸ ਨਾਲ਼ ਕਿ ਸਮਾਂ ਵੀ ਬਹੁਤ ਲੋਕਾਂ ਦਾ ਖਰਾਬ ਹੁੰਦਾ ਸੀ ਅਤੇ ਬਹੁਤ ਹੀ ਦੂਰ ਜਾ ਕੇ ਆਪਣੇ ਬੈਂਕ ਵਿੱਚ ਜਾ ਕੇ ਸਹੂਲਤ ਲੈਣੀ ਪੈਂਦੀ ਸੀ ਅੱਜ ਕੱਲ੍ਹ ਹਰੇਕ ਸਹੂਲਤ ਔਨਲਾਈਨ ਹੋ ਗਈ ਹੈ ਜਿਸ ਨਾਲ਼ ਤੁਸੀਂ ਘਰ ਬੈਠੇ ਵੀ ਆਪਣਾ ਹਰੇਕ ਸਹੂਲਤ ਦਾ ਹਾਸਲ ਕਰ ਸਕਦੇ ਹੋ